ਸਕੂਲ ਦੇ ਵਿੱਚ ਪੜ੍ਹਨ ਵੇਲੇ ਬਹੁਤ ਸਾਰੀ ਸਹੂਲਤਾਂ ਦੀ ਜ਼ਰੂਰਤ ਪੈਂਦੀ ਹੈ ਕੇਵਲ ਬੱਚਿਆਂ ਲਈ ਹੀ ਨਹੀਂ ਬਲਕਿ ਅਧਿਆਪਕਾਂ ਨੂੰ ਵੀ ਬਹੁਤ ਸਾਰੀਆਂ ਸਹੂਲਤਾਂ ਦੀ ਲੋੜ ਹੁੰਦੀ ਹੈ ਸਾਡੇ ਸਕੂਲ ਦੇ ਵਿੱਚ ਕਈ ਸਹੂਲਤਾਂ ਦੀ ਕਮੀ ਹੈ ਜਿਸ ਵਿੱਚ ਅਧਿਆਪਕਾਂ ਨੂੰ ਪ੍ਰੇਸ਼ਾਨੀ ਆਉਂਦੀ ਹੈ ਸਾਡੇ ਸਕੂਲ ਦਾ ਬਾਥਰੂਮ ਕੋਈ ਬਹੁਤਾ ਵਧੀਆ ਨਹੀਂ ਹੈ ਉਸ ਦਾ ਦਰਵਾਜ਼ਾ ਵੀ ਨਹੀਂ ਹੈ ਬਲਕਿ ਉਸ ਦੇ ਉੱਤੇ ਇੱਕ ਦਰੀ ਲਮਕਾ ਕੇ ਕੰਮ ਚਲਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਸਾਡੇ ਸਕੂਲ ਦੇ ਇੱਕ ਜਮਾਤ ਦੀ ਛੱਤ ਡਿੱਗੀ ਹੋਈ ਹੈ ਜਿਸ ਕਾਰਨ ਅਧਿਆਪਕਾਂ ਨੂੰ ਤਿੰਨ ਕਮਰਿਆਂ ਦੇ ਵਿੱਚ ਹੀ ਸਕੂਲ ਚਲਾਉਣਾ ਪੈ ਰਿਹਾ ਹੈ ਇਸ ਤੋਂ ਇਲਾਵਾ ਸਾਡੇ ਸਕੂਲ ਦੇ ਵਿੱਚ ਬਲੈਕ ਬੋਰਡ ਬਿਲਕੁਲ ਖਰਾਬ ਹੋਏ ਹੋਏ ਹਨ ਅਤੇ ਉਹਨਾਂ ਵਿੱਚ ਟੋਏ ਪਏ ਹਨ ਜਿਸ ਕਰਕੇ ਅਧਿਆਪਕ ਨੂੰ ਬਲੈਕ ਬੋਰਡ ਦੇ ਉੱਤੇ ਲਿਖਣ ਵੇਲੇ ਪਰੇਸ਼ਾਨੀ ਆਉਂਦੀ ਹੈ ਜੇਕਰ ਇਹ ਸਾਰੀਆਂ ਚੀਜ਼ਾਂ ਨੂੰ ਦੂਰ ਕਰ ਦਿੱਤਾ ਜਾਵੇ ਤਾਂ ਸਾਡਾ ਸਕੂਲ ਬੜਾ ਵਧੀਆ ਸਕੂਲ ਬਣ ਸਕਦਾ ਹੈ